ਅਸੀਂ ਬਰਤਨ ਧੋਣ ਲਈ ਕਾਫੀ ਵਿਮ ਯੂਜ ਕਰਦੇ ਹਾਂ ਅਤੇ ਆਪਣਾ ਓਇਲੀ ਹੁੰਦੇ ਨੇ ਉਹ ਅਸੀਂ ਯੂਜ ਕੀਤਾ ਸੀਗਾ ਅਤੇ ਕਾਫੀ ਟਾਈਮ ਤੋਂ ਮੈਂ ਵਿੰਮ ਯੂਜ਼ ਕਰਦਾ ਅਤੇ ਆਪਣਾ ਕਹਿਣ ਦਾ ਮਤਲਬ ਵਿੰਮ ਤੋਂ ਇਲਾਵਾ ਮੈਂ ਓਇਲੀ ਹੁੰਦੇ ਨੇ ਬਹੁਤ ਟਾਈਮ ਤੋਂ ਕਾਫੀ ਟਾਈਮ ਤੋਂ ਮੈਂ ਕਰਦਾ ਯੂਜ ਕਰਦਾ ਪਿਆ ਕਈ ਵਾਰ ਹੁੰਦਾ ਕਿ ਆਪ ਹੀ ਧੋਣੇ ਪੈਂਦੇ ਸਾਨੂੰ ਭਾਂਡੇ ਕਈ ਵਾਰੀ ਮਿਸਿਜ਼ ਗਏ ਹੁੰਦੇ ਨੇ ਮਾਈਕੇ ਗਏ ਹੁੰਦੇ ਨੇ ਸਾਨੂੰ ਆਪ ਨੂੰ ਧੋਣੇ ਪੈਂਦੇ ਨੇ ਭਾਂਡੇ ਕਾਫੀ ਟਾਇਮ ਤੋਂ ਯਾਨੀ ਕਿ ਅਸੀਂ ਆਪ ਯੂਜ਼ ਕਰਦੇ ਪਏ ਹਾਂ ਅਤੇ ਵਿੰਮ ਯੂਜ ਕਰਦੇ ਹਾਂ ਵਿੰਮ ਨਾਲ ਕਾਫੀ ਯਾਨੀ ਕਿ ਓਈਲੀ ਉਇਲੀ ਵਾਲੇ ਹੁੰਦੇ ਨੇ ਆਇਲ ਵਾਲੇ ਹੁੰਦੇ ਨੇ ਅਤੇ ਉਹ ਸਾਫ ਸਫੱਈਆ ਹੋ ਜਾਂਦਾ ਉਹਨਾਂ ਦਾ ਵਧੀਆ ਅਤੇ ਹੋਰ ਕੋਈ ਉਹ 'ਚ ਇਸ਼ੂ ਨਹੀਂ ਹੈਗਾ ਉਹ 'ਚ ਅਗਰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਵਿੰਮ ਹੀ ਯੂਜ ਕਰਦੇ ਹਾਂ ਜ਼ਿਆਦਾਤਰ ਲਿਕੁਅਡ ਵੀ ਆਉਂਦਾ ਲਿਕੁਅਡ ਵੀ ਯੂਜ਼ ਕਰਦੇ ਹਾਂ ਅਸੀਂ ਅਤੇ ਆਪਣਾ ਕਾਫੀ ਯਾਨੀ ਕਿ ਠੀਕ ਹੈ ਵਿੰਮ ਯੂਜ ਕਰਦੇ ਹਾਂ ਅਸੀਂ ਵਿਮ ਯੂਜ ਕਰ